ਸਾਡੇ ਘਰ ਦੇ ਨਾਲ ਥੋੜ੍ਹੀ ਜਿਹੀ ਜਗ੍ਹਾ ਹੈ ਜਿਹਦੇ ਵਿੱਚ ਮੈਂ ਫਲ਼ਦਾਰ ਫੁੱਲ ਵਾਲੇ ਪੌਦੇ ਅਤੇ ਕੁਛ ਵੇਲਾਂ ਲਾਉਂਦੇ ਹਾਂ ਜਿਹੜੇ ਫਲ਼ਦਾਰ ਪੌਦੇ ਨੇ ਉਹ ਤਾਂ ਸਾਨੂੰ ਵਧੀਆ ਫਲ਼ ਦਿੰਦੇ ਨੇ ਜਿਵੇਂ ਕਿ ਹੁਣ ਅਸੀਂ ਪਿਛਲੀ ਵਾਰੀ ਅੰਬ ਲਾਏ ਸੀ ਅਤੇ ਨਿੰਬੂ ਵੀ ਲਾਏ ਹੋਏ ਨੇ ਉਹ ਤੋਂ ਬਾਅਦ ਕੜੀ ਪੱਤਾ ਅਤੇ ਸੋਹੰਜਣਾ ਦਾ ਦਰੱਖਤ ਲਾਇਆ ਹੋਇਆ ਜਿਹਦੇ ਕਿ ਸਾਨੂੰ ਕਾਫੀ ਚੀਜ਼ਾਂ ਮਿਲਦੀਆਂ ਨੇ ਅਤੇ ਹੋਰ ਜਿਹੜੇ ਵੇਲਾਂ ਨੇ ਉਹ ਅਸੀਂ ਜਿਵੇਂ ਤੋਰੀ ਦੀ ਵੇਲਾਂ ਕੱਦੂ ਦੀ ਵੇਲਾਂ ਅਤੇ ਪੇਠੇ ਦੀ ਵੇਲਾਂ ਲਾਈਆਂ ਜਿਹਦੇ ਕਰਕੇ ਕਿ ਸਾਨੂੰ ਬਜ਼ਾਰ ਨਾਲ ਜਿਹੜੇ ਅੱਜ ਕੱਲ੍ਹ ਬਜ਼ਾਰਾਂ 'ਚ ਕੀਟਨਾਸ਼ਕ ਦਵਾਈ ਦੇ ਨਾਲ ਸਬਜ਼ੀ ਮਿਲਦੀ ਆ ਉਸ ਤੋਂ ਅਸੀਂ ਬਚੇ ਰਹਿੰਦੇ ਹਾਂ